ਤੈਰਾਕੀ ਦੇ ਸਾਡੀ ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਫਾਇਦੇ ਹਨ ਸਵਿਮਿੰਗ ਸਾਡੇ ਸਰੀਰ ਲਈ ਬਹੁਤ ਲਾਇ ਲਾਭਦਾਇਕ ਹੁੰਦੀ ਹੈ ਇਸਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਵੇਂ ਕਿ ਇਹ ਸਰੀਰ ਨੂੰ ਤਾਜ਼ਗੀ ਅਤੇ ਸ਼ਕਤੀ ਦਿੰਦੀ ਹੈ ਅਤੇ ਸਰੀਰਕ ਸਿਹਤ ਨੂੰ ਸੁਧਾਰਦੀ ਹੈ ਸਵਿਮਿੰਗ ਕਰਕੇ ਅਸੀਂ ਆਪਣੇ ਪੇਟ ਅਤੇ ਪਿੱਠ ਅਤੇ ਕੁੱਲ੍ਹੜ ਦੀਆਂ ਮਸਲਾਂ ਨੂੰ ਤਨਾਓ ਦਿੰਦੇ ਹਾਂ ਜੋ ਕਿ ਸਾਨੂੰ ਇੱਕ ਮਜ਼ਬੂਤ ਅਤੇ ਲੰਬੇ ਸਮੇਂ ਲਈ ਆਪਣੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ ਤੈਰਾਕੀ ਨਾਲ ਸਾਨੂੰ ਅਸੀਂ ਆਪਣੇ ਹਾਰਟ ਦੇ ਸਿਸਟਮ ਨੂੰ ਤਾਜ਼ਗੀ ਅਤੇ ਤਾਕਤ ਵਧਾ ਸਕਦੇ ਹਾਂ ਅਤੇ ਦਿਲ ਸੰਬੰਧੀ ਸਮੱਸਿਆਵਾਂ ਨੂੰ ਵੀ ਘੱਟ ਕਰ ਸਕਦੇ ਹਾਂ ਇਸ ਨਾਲ ਸਾਡਾ ਨਰਵਸ ਸਿਸਟਮ ਵੀ ਸ਼ਾਂਤ ਰਹਿੰਦਾ ਹੈ ਅਤੇ ਅਸੀਂ ਸੁਹਾਵਣੇ ਅਤੇ ਚਮਕੀਲੀ ਤਵਾਚਾ ਦੇ ਆਦੀ ਹੋ ਜਾਂਦੇ ਹਾਂ ਇਸ ਤੋਂ ਇਲਾਵਾ ਸਵਿਮਿੰਗ ਤਨਾਵ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ ਸਵਿਮਿੰਗ ਨਾਲ ਸਾਡਾ ਸਾਹ ਨਿਯੰਤਰਣ ਵਿੱਚ ਰਹਿੰਦਾ ਹੈ ਜਿਵੇਂ ਅਸੀਂ ਸਵਿਮਿੰਗ ਕਰਦੇ ਸਮੇਂ ਪੇਟ ਪਿੱਠ ਅਤੇ ਕੁੱਲ੍ਹੜ ਦੀਆਂ ਮਸਲਾਂ ਨੂੰ ਤਨਾਵ ਦਿੰਦੇ ਹਾਂ ਜਿਸ ਨਾਲ ਇੱਕ ਮਜ਼ਬੂਤ ਸਾਹ ਦਾ ਨਿਯੰਤਰਣ ਪੈਦਾ ਹੁੰਦਾ ਹੈ ਅਤੇ ਸਾਡੇ ਸਾਹ ਵਿੱਚ ਆਕਸੀਜਨ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਨਾਲ ਸਾਡੀ ਤੈਰਾਕੀ ਕਾਰਨ ਸਾਡਾ ਸਿਹਤ ਸਹੀ ਰਹਿੰਦੀ ਹੈ ਅਤੇ ਤੰਦਰੁਸਤੀ ਬਣੀ ਰਹਿੰਦੀ ਹੈ